ਤੈਰਾਕੀ ਦੇ ਦੌਰਾਨ ਮੈਨੂੰ ਪਤਾ ਸੀ ਵੀ ਜੋ ਅੱਛਾ ਇਹਦੇ ਸਰੀਰ ਅੰਦਰ ਅੱਛਾ ਵੀ ਪਾਣੀ ਉਹ ਕਿੱਦਾਂ ਬਾਹਰ ਆਪਣਾ ਕੱਢਿਆ ਜਾਵੇ ਤਾਂ ਜੋ ਮੈਂ ਉਹ ਇਹ ਆਪਣਾ ਤਰੀਕੇ ਇਸਤੇਮਾਲ ਆਪਣਾ ਕਰਕੇ ਉਸ ਵੀ ਉਹਦੇ ਸਰੀਰ ਦੇ ਅੰਦਰ ਪਾਣੀ ਆਪਣਾ ਕੱਢ ਕੇ ਉਹ ਬੰਦੇ ਦੇ ਸਾਹ ਚੱਲਦੇ ਆਪਣਾ ਕੀਤੇ ਆਪਣੇ ਜਿਹਦੇ ਨਾਲ ਉਹ ਬੰਦੇ ਦੀ ਜਾਨ ਬਚ ਸਕੀ ਅਤੇ ਉਹ ਬੰਦੇ ਨੇ ਹੀ ਮੇਰਾ ਧੰਨਵਾਦ ਕੀਤਾ